ਯੋਗਾ ਦਾ ਅਭਿਆਸ ਸ਼ੁਰੂ ਕਰਦੇ ਸਮੇਂ ਅਨੁਕੂਲ ਆਸਨ ਸੌਖੇ ਹੀ ਰੱਖੇ ਜਾਂਦੇ ਹਨ ਜਿਵੇਂ ਸਭ ਤੋਂ ਪਹਿਲਾਂ ਤਾਂ ਆਸਨ ਵਿਛਾ ਕੇ ਆਰਾਮ ਨਾਲ ਸੁੱਖ ਆਸਨ ਅਰਧ ਸੁਖ ਆਸਨ ਕਮਲ ਆਸਨ ਵਿੱਚ ਬੈਠਣਾ ਫਿਰ ਸਾਨੂੰ ਆਪਣੇ ਸਾਹਾਂ 'ਤੇ ਨਿਅੰਤਰਨ ਕਰਦੇ ਹੋਏ ਅੱਖਾਂ ਬੰਦ ਕਰਕੇ ਸਾਹਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰਾਣਾਯਾਮ ਆਉਂਦੇ ਹਨ